ਹੈਲੋ ਹਾਂਜੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਜੀ ਮੈਂ ਤਿੰਨ ਸਕੂਲ ਵਿਜ਼ਿਟ ਕੀਤੇ ਨੇ ਜੀ ਇੱਕ ਵਾਈ ਪੀ ਐੱਸ ਇੱਕ ਸ਼ਿਵਾਲਿਕ ਅਤੇ ਇੱਕ ਡੀ ਏ ਵੀ ਇਹ ਤਿੰਨਾਂ ਵਿੱਚੋਂ ਮੈਨੂੰ ਸ਼ਿਵਾਲਿਕ ਸਕੂਲ ਜ਼ਿਆਦਾ ਬਿਹਤਰ ਲੱਗਿਆ ਕਿਉਂਕਿ ਇਸਦੀ ਫੀਸਾਂ ਵੀ ਘੱਟ ਨੇ ਅਤੇ ਇੱਥੇ ਜਿਹੜੀ ਕੁਆਲਿਟੀ ਔਫ ਐਜੂਕੇਸ਼ਨ ਹੈ ਉਹ ਵੀ ਬਹੁਤ ਹੀ ਜ਼ਿਆਦਾ ਉੱਚੀ ਹੈ ਜੀ ਮੇਰੇ ਪੰਜ ਸੱਤ ਦੋਸਤ ਨੇ ਜਿਨ੍ਹਾਂ ਦੇ ਬੱਚੇ ਸ਼ਿਵਾਲਿਕ ਸਕੂਲ ਵਿੱਚ ਦੋ ਚਾਰ ਸਾਲ ਤੋਂ ਪੜ੍ਹ ਰਹੇ ਨੇ ਉਹ ਸਕੂਲ ਬਹੁਤ ਹੀ ਵਧੀਆ ਹੈ ਜੀ ਸਮਾਰਟ ਕਲਾਸਿਸ ਨੇ ਅਤੇ ਫੀਸਾਂ ਵੀ ਠੀਕ ਠਾਕ ਹੀ ਨੇ ਤੁਸੀਂ ਨਿਸ਼ਚਿੰਤ ਹੋ ਕੇ ਉੱਥੇ ਹੀ ਆਪਣੀ ਬੱਚੀ ਦੀ ਅਡਮਿਸ਼ਨ ਕਰਵਾ ਦਿਉ ਅਤੇ ਮੈਂ ਤਾਂ ਕੱਲ੍ਹ ਜਾ ਕੇ ਆਪਣੀ ਬੇਟੀ ਦੀ ਅਡਮਿਸ਼ਨ ਕਰਵਾ ਆਇਆ ਹਾਂ ਜੀ ਹਾਂਜੀ ਸਕੂਲ ਦੀਆਂ ਬੱਸਾਂ ਖੁਦ ਹੀ ਬੱਚਿਆਂ ਨੂੰ ਲੈ ਕੇ ਜਾਵੇਗੀ ਹਾਂਜੀ ਸਹੀ ਗੱਲ ਹੈ ਜੀ ਹਾਂਜੀ ਜੀ ਬਿਲਕੁਲ ਠੀਕ ਹੈ ਜੀ ਧੰਨਵਾਦ ਜੀ